ਤਰਨ ਤਾਰਨ ਵਿੱਚ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਇੱਥੇ ਸਿੱਖ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਕਿਤੇ ਨਾ ਕਿਤੇ ਥੋੜ੍ਹੇ ਬਹੁਤ ਮੁਸਲਮਾਨ ਵੀ ਰਹਿੰਦੇ ਨੇ ਰੀਤੀ ਰਿਵਾਜ਼ ਇਹ ਹੈ ਕਿ ਹਰ ਧਰਮ ਦੇ ਅਕੋਰਡਿੰਗਲੀ ਇਹ ਹਰ ਹਰ ਮਤਲਬ ਵੱਖ ਵੱਖ ਰੀਤੀ ਰਿਵਾਜ਼ ਹਨ ਵੱਖ ਵੱਖ ਅਭਿਆਸ ਹੈ ਵੱਖ ਵੱਖ ਧਰਮਾਂ ਦੇ ਲੋਕ ਜਿੱਦਾਂ ਕਿ ਉਹ ਕਿਹੜੇ ਕਿਹੜੇ ਅਭਿਆਸ ਵਿੱਚ ਸ਼ਾਮਿਲ ਹੁੰਦੇ ਆ ਉਹ ਹਰ ਅਭਿਆਸ ਵਿੱਚ ਸ਼ਾਮਿਲ ਹੁੰਦੇ ਨੇ ਅਗਰ ਪੰਜਾਬੀ ਅ ਮਤਲਬ ਜਿੱਦਾਂ ਸਿੱਖ ਆ ਉਹ ਘਰੇ ਪਾਠ ਰਖਵਾਉਂਦੇ ਆ ਤਾਂ ਹਿੰਦੂ ਲੋਕ ਵੀ ਆਉਂਦੇ ਆ ਹਿੰਦੂ ਲੋਕ ਗੁਰਦੁਆਰੇ ਵੀ ਜਾਂਦੇ ਆ ਈਵਨ ਸਿੱਖ ਵੀ ਕਿਤੇ ਨਾ ਕਿਤੇ ਮੰਦਿਰ ਜਾਂਦੇ ਆ ਕਈ ਸਿੱਖ ਅਤੇ ਹਿੰਦੂ ਜਿਹੜੇ ਲੋਕ ਆ ਉਹ ਚਰਚ ਵੀ ਜਾਂਦੇ ਆ ਸੋ ਇੱਥੇ ਹਰ ਧਰਮ ਦਾ ਜਿਹੜਾ ਅਭਿਆਸ ਆ ਉਹ ਸ਼ਾਮਿਲ ਹੈ ਹੀ ਹੈਗਾ ਵਾ ਵੱਖ ਵੱਖ ਲੋਕ ਵੱਖ ਵੱਖ ਜਗ੍ਹਾ 'ਤੇ ਵੱਖ ਵੱਖ ਧਰਮਾਂ ਨੂੰ ਮੰਨਦੇ ਨੇ ਔਰ ਜਾਂਦੇ ਆ ਹਾਂ ਮੈਂ ਅਗਰ ਕੋਈ ਵਿਦੇਸ਼ੀ ਆ ਜਿਹੜਾ ਉਹ ਤਰਨ ਤਾਰਨ ਵਿੱਚ ਆਵੇ ਤਾਂ ਆਪਾਂ ਉਹਨੂੰ ਇਹ ਚੀਜ਼ ਦਿਖਾਵਾਂਗੇ ਉਹ ਬੈਸਟ ਐਗਜਾਮਪਲ ਜਿਹੜਾ ਰਹੂੰਗਾ ਆ ਉਹ ਆ ਘਰ ਦੇ ਵਿੱਚ ਪਾਠ ਆ ਹੁਣ ਘਰ ਦੇ ਵਿੱਚ ਪਾਠ ਹੋਊਗਾ ਤਾਂ ਸਾਰੇ ਆਉਣਗੇ ਬਜ਼ੁਰਗ ਲੋਕ ਵੀ ਆਉਣਗੇ ਬੱਚੇ ਵੀ ਆਉਣਗੇ ਅਤੇ ਹਾਂ ਪਾਠ ਆ ਯਾਨੀ ਕਿ ਪਾਠ ਤੋਂ ਬਾਅਦ ਜਦੋਂ ਭੋਗ ਪਊਗਾ ਕੀਰਤਨ ਵੀ ਹੁੰਦਾ ਵਾ ਸੋ ਜਿੱਦਾਂ ਕਿ ਜਿੱਦਾਂ ਜਵਾਨ ਲੋਕ ਆ ਓਹ ਬੁੱਢਿਆਂ ਨੂੰ ਮਤਲਬ ਪੈਰੀ ਹੱਥ ਲਗਾਉਂਦੇ ਆ ਬੱਚਿਆਂ ਨੂੰ ਪਿਆਰ ਨਾਲ ਬੁਲਾਉਂਦੇ ਆ ਸੋ ਉਹ ਸਭ ਚੀਜ਼ਾਂ ਜਿੱਦਾਂ ਕਿ ਉਹ ਇੱਕ ਵਿਦੇਸ਼ੀ ਦੇਖੂਗਾ ਕਿ ਹਾਂ ਕਿਉਂਕਿ ਜਿੱਦਾਂ ਬਾਹਰਲੇ ਮੁਲਖਾਂ ਵਿੱਚ ਤਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਨਾ ਕਿ ਆਪਣੇ ਪੇਰੈਂਟਸ ਦੇ ਪੈਂਰੀ ਹੱਥ ਲਗਾਉਣਾ ਵਾ ਰਿਸਪੈਕਟ ਕਰਨੀ ਕਿਉਂਕਿ ਅਠਾਰ੍ਹਾਂ ਸਾਲ ਤੋਂ ਬਾਅਦ ਤਾਂ ਵੈਸੇ ਹੀ ਬੱਚੇ ਮਤਲਬ ਆਪਣੇ ਪੇਰੈਂਟਸ ਤੋਂ ਜ਼ਿਆਦਾਤਰ ਅਲੱਗ ਹੀ ਰਹਿੰਦੇ ਨੇ ਇੱਦਾਂ ਨਹੀਂ ਨਾ ਹੁੰਦਾ ਕਿ ਇੰਡੀਆ ਵਾਂਗ ਕਿ ਉਹ ਸਾਰਾ ਟਾਈਮ ਆਪਣੇ ਬੱਚਿਆਂ ਨਾਲ ਰਹਿੰਦੇ ਆ ਉਹ ਵੀ ਚੀਜ਼ਾਂ ਕਿ ਉਹਨਾਂ ਨੂੰ ਇਹ ਚੀਜ਼ ਪਤਾ ਨਹੀਂ ਨਾ ਕਿ ਹਾਂ ਕਿ ਆਪਣੇ ਸਾਰੀ ਜ਼ਿੰਦਗੀ ਆਪਣੇ ਪੇਰੈਂਟਸ ਨਾਲ ਕਿੱਦਾਂ ਸਪੈਂਡ ਕਰਦੇ ਆਂ ਜਾਂ ਇੱਕ ਵੱਡੇ ਮਤਲਬ ਐਲਡਰ ਦੀ ਰਿਸਪੈਕਟ ਕਿੱਦਾਂ ਕਰਦੇ ਆ ਸੋ ਜਦੋਂ ਇੱਕ ਵਿਦੇਸ਼ੀ ਆਊਗਾ ਦੇਖੂਗਾ ਕਿ ਕਿੱਦਾਂ ਪੰਜਾਬੀ ਲੋਕ ਮਤਲਬ ਕਿੱਦਾਂ ਲੋਕ ਪੰਜਾਬੀ ਹੋਵੇ ਹਿੰਦੂ ਹੋਵੇ ਕੋਈ ਵੀ ਹੋਵੇ ਉਹ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਦੇ ਆ ਉਹਨਾਂ ਨੂੰ ਘਰ ਰੱਖਦੇ ਉਹਨਾਂ ਦੀ ਹਰ ਚੀਜ਼ ਦਾ ਧਿਆਨ ਰੱਖਦੇ ਆ ਉਹਨਾਂ ਦੇ ਪੈਰੀ ਹੱਥ ਲਗਾਉਂਦੇ ਆ ਬੱਚਿਆਂ ਨਾਲ ਪਿਆਰ ਨਾਲ ਗੱਲ ਕਰਦੇ ਆ ਬਾਕੀ ਜਿੱਦਾਂ ਕਿ ਹਾਂ ਖਾਣਾ ਵੀ ਆ ਜਿੱਦਾਂ ਅ ਭੋਗ ਪਿਆ ਵਾ ਅਤੇ ਫਿਰ ਲੰਗਰ ਵਰਤਾਇਆ ਜਾਊਗਾ ਕਿ ਉਹਨਾਂ ਨੂੰ ਇਹ ਵੀ ਪਤਾ ਲੱਗੂਗਾ ਕਿ ਹਾਂ ਪੰਜਾਬ ਦਾ ਫੂਡ ਕੀ ਆ ਜਿੱਦਾਂ ਕੀ ਮੇਨ ਪੰਜਾਬ ਵਿੱਚ ਜਾਂ ਫਿਰ ਦਾਲ ਰੋਟੀ ਦਾਲ ਰੋਟੀ ਚਾਵਲ ਲੰਗਰ ਵਿੱਚ ਵੀ ਦਾਲ ਰੋਟੀ ਤਾਂ ਰੱਖਦੇ ਹੀ ਰੱਖਦੇ ਆ ਸੋ ਇਹ ਹੀ ਚੀਜ਼ਾਂ ਨੇ ਕਿ ਇੱਕ ਜਦੋਂ ਵਿਦੇਸ਼ੀ ਦੇਖੂਗਾ ਕਿ ਹਾਂ ਇੱਦਾਂ ਦਾ ਟਰਡੀਸ਼ਨ ਔਰ ਵੈਸੇ ਵੀ ਲੋਕ ਕਹਿੰਦੇ ਆ ਕਿ ਜਿੱਦਾਂ ਬਾਹਰਲੇ ਲੋਕ ਉਹਨਾਂ ਨੂੰ ਇੰਡੀਅਨ ਕਲਚਰਸ ਵਿੱਚ ਕਾਫ਼ੀ ਜ਼ਿਆਦਾ ਇੰਟਰਸਟ ਹੁੰਦਾ ਵਾ